ਮਨੁੱਖ ਅਲੱਗ ਅਲੱਗ ਗ੍ਰਹਿਆਂ 'ਤੇ ਪਹੁੰਚ ਚੁੱਕਿਆ ਹੈ ਜਿਵੇਂ ਕਿ ਮੰਗਲ 'ਤੇ ਚੰਦ 'ਤੇ ਉੱਥੇ ਜਾ ਕੇ ਉਹਨਾਂ ਨੇ ਇਹ ਨਿਰੀਖਣ ਕੀਤਾ ਹੈ ਕਿ ਉੱਥੇ ਪਾਣੀ ਦੇ ਤੱਤ ਬਿਲਕੁਲ ਨਹੀਂ ਹਨ ਜਿਸ ਨਾਲ ਕਿ ਸਾਡਾ ਉੱਥੇ ਰਹਿਣਾ ਹੀ ਸੰਭਵ ਨਹੀਂ ਹੈ ਕਿਉਂਕਿ ਪਾਣੀ ਸਾਡੇ ਸਰੀਰ ਲਈ ਜ਼ਰੂਰੀ ਹੈ ਅਤੇ ਪਾਣੀ ਦਾ ਸੱਤਰ ਪ੍ਰਸੈਂਟ ਭਾਗ ਸਾਡੇ ਸਰੀਰ ਦਾ ਹੈ ਪਾਣੀ ਹੈ ਜਿਸ ਨਾਲ ਕਿ ਅਸੀਂ ਜੀਵਤ ਰਹਿ ਸਕਦੇ ਹਾਂ ਅਤੇ ਜਿਵੇਂ ਹੋਰ ਕੋਈ ਕ ਹੋਰ ਕਈ ਕਾਰਜਾਂ ਵਿੱਚ ਹੀ ਪਾਣੀ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਖਾਣਾ ਖਾਣਾ ਬਣਾਉਣ ਲਈ ਜਾਂ ਫਿਰ ਕੁਝ ਉਗਾਉਣ ਲਈ ਖੇਤੀ ਕਰਨ ਲਈ ਆਦਿ ਇਹਨਾਂ ਲਈ ਸਿ ਸਿਰਫ ਪਾਣੀ ਦਾ ਹੀ ਯੂਜ਼ ਹੁੰਦਾ ਹੈ ਜਿਸ ਨਾਲ ਕਿ ਜਿਸ ਨਾਲ ਕਿ ਅਗਰ ਉੱਥੇ ਪਾਣੀ ਹੀ ਨਹੀਂ ਹੈ ਤਾਂ ਸਾਡਾ ਜੀਵਨ ਹੀ ਸੰਭਵ ਨਹੀਂ ਹੈ ਨਾ ਹੀ ਅਸ ਅਸੀਂ ਜੀਵਿਤ ਰਹਿ ਸਕਦੇ ਹਾਂ ਇਸ ਕਰਕੇ ਸਾਡਾ ਧਰਤੀ 'ਤੇ ਹੀ ਜੀਵਨ ਸੰਭਵ ਹੈ ਅਤੇ ਸੁਰੱਖਿਅਤ ਹੈ